ਹਾਂ ਇਹ ਸੱਚ ਹੈ ਕਿ ਅਸੀਂ ਆਪਣੇ ਸਰੀਰ ਨੂੰ ਸੰਤੁਲਿਤ ਰੱਖ ਸਕਦੇ ਹਾਂ ਜਿਸ ਨਾਲ ਅਸੀਂ ਆਪਣਾ ਮਤਲਬ ਅਸ ਅ ਭੋਜਨ ਅ ਖਾਣ ਨਾਲ ਸਾਨੂੰ ਸਰੀਰ ਨੂੰ ਸੰਤੁਲਿਤ ਅ ਮਿਲਦੀ ਹੈ ਸੰਤੁਲਨਾ ਮਿਲਦੀ ਹੈ ਜੋ ਕਿ ਜਿਵੇਂ ਕਿ ਸੰਤੁ ਹੈ ਨਾ ਸੰਤੁਲਿਤ ਰੱਖਣਾ ਜੋ ਕਿ ਅਸੀਂ ਤਲੀਆਂ ਹੋਈਆਂ ਚੀਜ਼ਾਂ ਬੰਦ ਸਕਦੇ ਹਾਂ ਜਿਵੇਂ ਕਿ ਬਰਗਰ ਵਗੈਰਾ ਨਿਊਡਲ ਵਗੈਰਾ ਕੁਝ ਇਸ ਤਰ੍ਹਾਂ ਨਾਲ ਸਾਡੇ ਸਰੀਰ ਵਿੱਚ ਆ ਗਰਮੀ ਮਹਿਸੂਸ ਹੁੰਦੀ ਆ ਜਿਹਨੂੰ ਸਾਹ ਚੜਨ ਦੀ ਪ੍ਰੋਬਲਮ ਹੁੰਦੀ ਹੈ ਤੇ ਅਤੇ ਇਹਦੇ ਨਾਲ ਭਾਰ ਵੀ ਜ਼ਿਆਦਾ ਹੁੰਦਾ ਅਤੇ ਮੋਟਾਪਾ ਵੀ ਜ਼ਿਆਦਾ ਵੱਧਦਾ ਹੈ ਸਾਡੇ ਇਸ ਲਈ ਸਾਨੂੰ ਸੰਤੁਲਨ ਰੱਖਣ ਦੇ ਲਈ ਹਰੀਆਂ ਸਬਜ਼ੀਆਂ ਖਾਣੀਆ ਚਾਹੀਦੀਆਂ ਹਨ ਅਤੇ ਸਮੇਂ ਸਿਰ ਉੱਠ ਕੇ ਸਾਨੂੰ ਕਸਰਤ ਕਰਨੀ ਚਾਹੀਦੀ ਹੈ ਅਤੇ ਸਰੀਰ ਦਾ ਸਹੀ ਢੰਗ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ ਜਿਸ ਨਾਲ ਕਿਸੇ ਵੀ ਤਰ੍ਹਾਂ ਦੀਆਂ ਕੋਈ ਹੋਰ ਬਿਮਾਰੀਆਂ ਜਾਂ ਭਾਵ ਰੋਗ ਨਹੀਂ ਲੱਗਦੇ ਕਿਸੇ ਨਾਲ ਸਾਨੂੰ ਮਤਲਬ ਚੰਗੀ ਤਰ੍ਹਾਂ ਭਾਲ ਮਹਿਸੂਸ ਜੋ ਕਿ ਭਾਰ ਕੱਢਦਾ ਹੈ ਅਤੇ ਸਾਨੂੰ ਕ ਸਾਹ ਲੈਣ ਵਿੱਚ ਕਸਰਤ ਕਰਨ ਵਿੱਚ ਕੋਈ ਦਿੱਕਤ ਨਹੀਂ ਹੁੰਦੀ ਇਸ ਲਈ ਸਾਨੂੰ ਸਮੇਂ ਸਿਰ ਕਸਰਤ ਕਰਨੀ ਚਾਹੀਦੀ ਹੈ ਅਤੇ ਸਰੀਰ ਦਾ ਭਾਰ ਘੱਟ ਕਰਨਾ ਚਾਹੀਦਾ ਹੈ ਜੋ ਕਿ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਜਿਸ ਨਾਲ ਸਰੀਰਕ ਸੰਤੁਲਨ ਤਾ ਖ਼ਰਾਬ ਨਹੀਂ ਹੁੰਦੀ ਅ ਸ ਸਰੀਰਕ ਸੰਤੁਲਨ ਓਦੋਂ ਖ਼ਰਾਬ ਹੁੰਦਾ ਜਦੋਂ ਅਸੀਂ ਤਲੀਆਂ ਸਬਜ਼ੀਆਂ ਤਲੀਆਂ ਚੀਜਾਂ ਖਾਂਦੇ ਹਾਂ ਜਾਂ ਤਲਿਆ ਹੋਇਆ ਕੁਛ ਵੀ ਜ਼ਿਆਦਾ ਪ੍ਰਾਪਤ ਕਰਦੇ ਹਾਂ ਜਿਸ ਨਾਲ ਸਾਡੇ ਸਰੀਰ ਵਿੱਚ ਮੋਟਾਪਾ ਪੈਦਾ ਹੁੰਦਾ ਹੈ ਜੋ ਕਿ ਚਮੜੀ ਨੂੰ ਮੋਟਾ ਹੁੰਦਾ ਹੈ ਇਸ ਲਈ ਸਾਨੂੰ ਅ ਸਾਡੇ ਸਰੀਰ ਵਿੱਚ ਆ ਤਲੇ ਹੋਏ ਚੀਜ਼ਾਂ ਖਾਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਜ ਜ ਜ ਜੇ ਉਹਦੇ ਨਾਲ ਜਿਸਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲਗਦੀਆਂ ਹਨ ਇਸ ਨਾਲ ਮਤਲਬ ਚਮੜੀ ਰੋਗ ਵੀ ਲੱਗ ਜਾਂਦਾ ਹੈ ਜੋ ਕਿ ਸਰੀਰ ਨੂੰ ਘਟਾਉਣ ਵਿੱਚ ਮਦਦ ਨਹੀਂ ਕਰਦਾ ਉਸ ਨੂੰ ਜ਼ਿਆਦਾਤਰ ਵਧਾ ਦਿੰਦਾ ਹੈ ਅਤੇ ਵੱਧ ਮਾਤਰਾ ਵਿੱਚ ਉਸ ਨੂੰ ਪੋਸ਼ਣ ਪ੍ਰਾਪਤ ਨਹੀਂ ਹੁੰਦਾ ਇਸ ਲਈ ਸਾਡੇ ਸਰੀਰ ਵਿੱਚ ਘਟਾਉਣ ਵਿੱਚ ਕਸਰਤ ਕਰਨੀ ਚਾਹੀਦੀ ਹੈ ਹੋਣੀ ਚਾਹੀਦੀ